ਭਾਰਤ ਵਿੱਚ ਅਲੱਗ ਅਲੱਗ ਬਹੁਤ ਤਰ੍ਹਾਂ ਦੇ ਨਾਚ ਹਨ ਹਰ ਇੱਕ ਰਾਜ ਦਾ ਆਪਣਾ ਇੱਕ ਅਲੱਗ ਨਾਚ ਹੈ ਜਿਨ੍ਹਾਂ ਵਿੱਚੋਂ ਕੁਝ ਮਰ ਮਸ਼ਹੂਰ ਨਾਚ ਇਹ ਹਨ ਜਿਵੇਂ ਕਿ ਗਿੱਧਾ ਭੰਗੜਾ ਲੁੱਡੀ ਝੁੰਮਰ ਮਲਵਈ ਗਿੱਧਾ ਡਾਂਡੀਆ ਕਲਾਸਿਕ ਕੱਥਕ ਗਰਬਾ ਮਨੀਪੁਰੀ ਰਾਸਲੀਲਾ ਭਾਰਤ ਨਾਟਯਮ ਹਨ ਇਹ ਕਈ ਮਸ਼ਹੂਰ ਨਾਚ ਹਨ ਅਤੇ ਨੂਰਾ ਫਤਹੀ ਮਸ਼ਹੂਰ ਨਾਚ ਕਰਦੀ ਹੈ ਅਤੇ ਉਹ ਬਹੁਤ ਹੀ ਮਸ਼ਹੂਰ ਹੈ ਉਹਦੇ ਬਹੁਤ ਸਾਰੇ ਗੀਤ ਹਨ ਜਿਵੇਂ ਕਿ ਦਿਲਬਰ ਦਿਲਬਰ ਸੌਂਗ ਉਸਦਾ ਬਹੁਤ ਹੀ ਮਸ਼ਹੂਰ ਹੋਇਆ ਸੀ ਉਸਦਾ ਨਾਚ ਉਸ ਵਿੱਚ ਬਹੁਤ ਸੋਹਣਾ ਹੈ ਅਤੇ ਉਹ ਤੋਂ ਪ੍ਰੇਰਨਾ ਲੈ ਕੇ ਬਹੁਤ ਲੋਕ ਡਾਂਸ ਕਰਦੇ ਹਨ ਜਿਵੇਂ ਕਿ ਮੈਂ ਵੀ ਉਸ ਤੋਂ ਪ੍ਰੇਰਨਾ ਲੈ ਕੇ ਡਾਂਸ ਸਿੱਖ ਰਹੀ ਸੀ ਅਤੇ ਕਈ ਵਿਆਹ ਵੀ ਅਟੈਂਡ ਕੀਤੇ ਅਤੇ ਡਾਂਸ ਕੀਤਾ ਮੈਨੂੰ ਉਸਦਾ ਨਾਚ ਬਹੁਤ ਵਧੀਆ ਲੱਗਦਾ ਹੈ ਉਹ ਬਾਹਰ ਤੋਂ ਆ ਕੇ ਉਹਨੇ ਭਾਰਤ ਵਿੱਚ ਆਪਣੀ ਇੱਕ ਅਲੱਗ ਥਾਂ ਬਣਾਈ ਜਗ੍ਹਾ ਬਣਾਈ ਅਤੇ ਉਹ ਬਹੁਤ ਹੀ ਵਧੀਆ ਡਾਂਸ ਕਰਦੀ ਹੈ